ਪੰਜਾਬੀ ਸੱਭਿਆਚਾਰ ਦਾ ਮੁੱਲ ਘਰ ਪੰਜਾਬ ਹੈ ਵਿਸ਼ੇਸ਼ ਸੱਭ ਸੱਭਿਆਚਾਰ ਦੀ ਪ੍ਰਮਾਣਿਕ ਹੋਂਦ ਵਿਸ਼ੇਸ਼ ਭੂ ਲਈ ਖਿੱਤੇ ਤੋਂ ਬਿਆਨ ਅਸੰਭਵ ਹੈ ਕਿਸੇ ਸੱਭਿਆਚਾਰ ਨੂੰ ਉਸਦੇ ਭੂਗੋਲਿਕ ਯੋਗ ਗਿਰਦੇ ਜਲਵਾਯੂ ਧਰਤੀ ਦੀ ਕਿਸਮ ਅਤੇ ਖਿੱਤੇ ਸੁਭਾਅ ਕੁਦਰਤੀ ਲੱਭਤਾ ਕੌਮਨ ਪਛਾਣਿਆ ਸਮਝਿਆ ਹੀ ਸਮਝਿਆ ਹੀ ਨਹੀਂ ਜਾ ਸਕਦਾ ਬਲਕਿ ਇਸ ਦੀ ਕਲਪਨਾ ਕਰਨਾ ਵੀ ਗਲਤ ਚੇਤਨਾ ਦਾ ਪ੍ਰਮਾਣ ਹੈ ਪੰਜਾਬੀ ਸੱਭਿਆਚਾਰ ਨੂੰ ਅਤੇ ਭੂਗੋਲਿਕ ਖਿਤੇ ਨਾਲ ਇਹ ਤੋੜ ਕੇ ਵੇਖਣ ਨਾ ਸੰਭਵ ਹੈ ਨਾ ਹੀ ਵਾਜਬ ਵਾਜਬ ਸਗੋਂ ਲੋੜ ਪੰਜਾਬੀ ਸੱਭਿਆਚਾਰ ਦੇ ਸੁੰਦਰ ਵਿੱਚ ਇਸਦੀ ਕਾਰਨ ਸਹੀ ਭੂਗੋਲਿਕ ਕਾਰਨ ਵੀ ਇਹ ਹੈ ਇਹ ਇਹ ਜੇ ਸਭ ਹਨ ਭੂਗੋਲਿਕ ਖੇਤਰ ਬਾਰੇ ਜੋ ਕਿ ਦੱਸਿਆ ਗਿਆ ਹੈ ਸਾਰਾ ਕੁਝ ਇਹੀ